ਹੈਲੋ ਸਰ ਸਵੀਗੀ ਤੋਂ ਬੋਲਦੇ ਆ ਸਰ ਮੈਂ ਕਿੰਗ ਬਰਗਰ ਔਡਰ ਕੀਤੇ ਸੀ ਜੋ ਮੈਨੂੰ ਅਜੇ ਨਹੀਂ ਮਿਲਿਆ ਪਰ ਮੈਨੂੰ ਡਿਲੀਵਰ ਸ਼ੋ ਹੋ ਰਿਹਾ ਅਤੇ ਮੈਨੂੰ ਬਰਗਰ ਅਜੇ ਨਹੀਂ ਮਿਲੇ ਮੈਨੂੰ ਔਡਰ ਨਹੀਂ ਮਿਲਿਆ ਤਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਪਲੀਜ਼ ਆਪਣੇ ਡਿਲੀਵਰ ਬੋਆਏ ਨੂੰ ਕਾਲ ਕਰਕੇ ਪੁੱਛੋ ਕਿ ਉਹਨਾਂ ਨੇ ਔਡਰ ਕਿੱਥੇ ਦਿੱਤਾ ਹੈ ਕਿਤੇ ਉਹ ਖੁਦ ਤਾਂ ਨਹੀਂ ਖਾ ਗਿਆ ਜੇ ਉਸਨੇ ਕਿਸੇ ਗਲਤ ਪਤੇ 'ਤੇ ਔਡਰ ਦੇ ਦਿੱਤਾ ਹੈ ਤਾਂ ਮੈਨੂੰ ਦੱਸ ਦੇ ਮੈਂ ਜਾ ਕੇ ਲੈ ਆਵਾਂਗੀ ਜੇ ਉਹਨੂੰ ਅਜੇ ਮੇਰਾ ਪਤਾ ਨਹੀਂ ਲੱਭਿਆ ਤਾਂ ਵੀ ਮੈਨੂੰ ਦੱਸ ਦੇ ਤਾਂ ਵੀ ਮੈਂ ਅੱਗੋਂ ਦੀ ਚਲ ਜਾਂਗੀ ਲੈਣ ਵਾਸਤੇ ਅਤੇ ਜੇ ਉਹਨੂੰ ਖੁਦ ਖਾ ਲਿਆ ਹੈ ਤਾਂ ਪਲੀਜ਼ ਉਹਤੇ ਕਾਰਵਾਈ ਕਰੋ ਕਿਉਂਕਿ ਮੈਂ ਤਾਂ ਪੈਸੇ ਵੀ ਔਨਲਾਈਨ ਦੇ ਚੁੱਕੀ ਹਾਂ ਇਸ ਤਰ੍ਹਾਂ ਤਾਂ ਮੇਰੇ ਪੈਸੇ ਵੀ ਬਰਬਾਦ ਹੋ ਜਾਣਗੇ ਅਤੇ ਪਲੀਜ਼ ਸਰ ਤੁਸੀਂ ਆਪਣੇ ਡਿਲੀਵਰ ਬੋਆਏ ਨੂੰ ਪੁੱਛੋ ਕਿ ਉਹਨਾਂ ਨੇ ਉਹ ਔਡਰ ਕਿੱਥੇ ਦਿੱਤਾ ਹੈ ਕਿਹਨੂੰ ਦਿੱਤਾ ਹੈ ਕਿਸੇ ਗਲਤ ਪਤੇ 'ਤੇ ਤਾਂ ਨਹੀਂ ਦੇ ਕੇ ਆ ਗਿਆ ਉਹ ਜੇ ਗਲਤ ਪਤੇ 'ਤੇ ਦਿੱਤਾ ਤਾਂ ਮੈਂ ਖੁਦ ਲੈ ਆਵਾਂਗੀ ਜੇ ਉਹ ਖੁਦ ਖਾ ਗਿਆ ਤਾਂ ਪਲੀਜ਼ ਉਸ 'ਤੇ ਕਾਰਵਾਈ ਕਰੋ ਸੋ ਥੈਂਕ ਯੂ ਸਰ